ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਅਤੇ ਭਾਰਤ ਵਿੱਚ ਟਰੈਕਟਰਾਂ ਦੇ ਬਹੁਤ ਸਾਰੇ ਬ੍ਰੈਂਡ ਦੇਖਣ ਨੂੰ ਮਿਲੇ ਹਨ ਇਸ ਤੋਂ ਪਹਿਲਾਂ ਖੇਤੀ ਰਵਾਇਤੀ ਢੰਗਾਂ ਨਾਲ ਹੁੰਦੀ ਸੀ ਜਿਸ ਵਿੱਚ ਮਸ਼ੀਨੀਕਰਨ ਦੀ ਕੋਈ ਜਗ੍ਹਾ ਨਹੀਂ ਸੀ ਪ੍ਰੰਤੂ ਟਰੈਕਟਰਾਂ ਅਤੇ ਹੋਰ ਸੰਦਾਂ ਦੇ ਆਉਣ ਨਾਲ ਮਸ਼ੀਨਰੀ ਦਾ ਯੁੱਗ ਆ ਚੁੱਕਾ ਹੈ ਜਿਸ ਵਿੱਚ ਮਜਦੂਰਾਂ ਦਾ ਕੰਮ ਘਟਿਆ ਹੈ ਅਤੇ ਮਸ਼ੀਨਰੀ ਦਾ ਕੰਮ ਵਧਿਆ ਹੈ ਰਵਾਇਤੀ ਢੰਗਾਂ ਤੋਂ ਜੋ ਕੰਮ ਕਾਫੀ ਸਮੇਂ ਵਿੱਚ ਹੁੰਦਾ ਸੀ ਉਹ ਕੰਮ ਮਸ਼ੀਨੀ ਯੁੱਗ ਵਿੱਚ ਟਰੈਕਟਰਾਂ ਦੀ ਮਦਦ ਨਾਲ ਬਹੁਤ ਛੇਤੀ ਅਤੇ ਸੁਖਾਲਾ ਹੋ ਜਾਂਦਾ ਹੈ